ਕੱਪੜਾ ਧੋਣਾ ਵੀ ਆਪਣੇ ਆਕ ਆਪ ਵਿੱਚ ਇੱਕ ਕਲਾ ਹੈ ਕੱਪੜੇ ਧੋਣ ਲਈ ਵੀ ਇੱਕ ਪ੍ਰੋਸੈਸ ਹੁੰਦਾ ਹੈ ਜੋ ਕੱਪੜੇ ਦਾ ਮਟੀਰਅਲ ਅਲੱਗ ਹੁੰਦਾ ਹੈ ਤਾਂ ਉਹਨਾਂ ਨੂੰ ਅਲੱਗ ਧੋਣਾ ਚਾਹੀਦਾ ਹੈ ਕੱਪੜੇ ਦਾ ਕੱਪੜੇ ਦਾ ਮਟੀਰੀਅਲ ਉਹਨਾਂ ਦੇ ਰੰਗਾਂ ਜਾਂ ਉਹਨਾਂ ਦੀ ਸਟਿਚ ਸਲਾਈ ਅਤੇ ਬੁਣਾਈ ਉੱਪਰ ਉੱਪਰ ਫਰਕ ਪਾਉਂਦਾ ਹੈ ਜਿਹੜੇ ਕੱਪੜੇ ਸਾਫ ਰੱਖਣ ਲਈ ਲੰਬੇ ਸਮੇਂ ਤੱਕ ਵਧੀਆ ਲੱਗਣ ਇਸ ਲਈ ਉਹਨਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਕਪੜੇ ਧੋਣ ਲਈ ਮੈਂ ਇੱਦਾਂ ਕਰਦਾ ਹਾਂ ਕਿ ਪਹਿਲਾਂ ਤਾਂ ਮੈਂ ਕੱਪੜੇ ਅਲੱਗ ਕਰਦਾ ਹਾਂ ਸਫੇਦ ਕੱਪੜੇ ਅਲੱਗ ਅਤੇ ਰੰਗੀਨ ਕੱਪੜੇ ਅਲੱਗ ਅਤੇ ਮੈਂ ਕੋਟਨ ਵੂਲ ਅਤੇ ਸਿੰਥੈਟਿਕ ਵਾਲੇ ਕੱਪੜੇ ਨੂੰ ਵਾਸ਼ਿੰਗ ਰਿਕੁਾਇਰਮੈਂਟ ਉਹਨਾਂ ਦੀ ਅਲੱਗ ਹੁੰਦੀ ਹੈ ਉਹਨਾਂ ਦੀ ਧੋਣ ਦੀ ਸੰਖਿਆ ਅਲੱਗ ਹੁੰਦੀ ਹੈ ਕਈ ਕੱਪੜਿਆਂ ਨੂੰ ਮੈਂ ਗਰਮ ਪਾਣੀ ਵਿੱਚ ਵਿੱਚ ਧੋਂਦਾ ਹਾਂ ਕਈ ਕੱਪੜਿਆਂ ਲਈ ਮੈਨੂੰ ਠੰਡਾ ਪਾਣੀ ਵੀ ਵਰਤਣਾ ਪੈਂਦਾ ਹੈ ਜ਼ਿਆਦਾਤਰ ਕੱਪੜੇ ਤਾਂ ਮੈਂ ਵਾਸ਼ਿੰਗ ਮਸ਼ੀਨ ਵਿੱਚ ਹੀ ਧੋਂਦਾ ਹਾਂ ਵਾਸ਼ਿੰਗ ਮਸ਼ੀਨ ਵਿੱਚ ਪਹਿਲਾਂ ਮੈਂ ਕੱਪੜੇ ਪਾਉਂਦਾ ਹਾਂ ਫਿਰ ਮੈਂ ਉਹਨਾਂ ਉੱਤੇ ਵਾਸ਼ਿੰਗ ਪਾਊਡਰ ਸਿੱਟ ਪਾਊਡਰ ਪਾਉਂਦਾ ਹਾਂ ਫਿਰ ਮੈਂ ਮਸ਼ ਵਾਸ਼ਿੰਗ ਮਸ਼ੀਨ ਨੂੰ ਔਨ ਕਰ ਦਿੰਦਾ ਹਾਂ ਹੈਵੀ ਕੱਪੜੇ ਗੰਦਗੀ ਕੋਟੀ ਜੈਕਟ ਜੀਨ ਵਗੈਰਾ ਤਾਂ ਮੈਂ ਮੈਂ ਮੈਂ ਖਾਸ ਤੌਰ 'ਤੇ ਵਾਸ਼ਿੰਗ ਮਸ਼ੀਨ ਨਾਲ ਹੀ ਧੋਂਦਾ ਹਾਂ ਹਲਕੇ ਕੱਪੜੇ ਦੀ ਟੀ ਸ਼ਰਟ ਬਨੈਨ ਵਗੈੜਾ ਮੈਂ ਹੱਥ ਨਾਲ ਧੋਂਦਾ ਹਾਂ ਉਹਨਾਂ ਨੂੰ ਸੁਖਾਉਣ ਦਾ ਤਰੀਕਾ ਅਲੱਗ ਹੈ ਜੇਕਰ ਧੁੱਪ ਨਾ ਨਿਕਲੇ ਤਾਂ ਮੈਂ ਡਰਾਇਰ ਦੀ ਮਦਦ ਨਾਲ ਉਹਨਾਂ ਨੂੰ ਸੁਕਾ ਲੈਂਦਾ ਹਾਂ ਡਰਾਇਰ ਦੀ ਮਦਦ ਨਾਲ ਮੈਂ ਕਮਰੇ ਵਿੱਚ ਪੱਖਾ ਲਾ ਕੇ ਤਾਰ ਨਾਲ ਵੀ ਸੁਕਾ ਲੈਂਦਾ ਹਾਂ ਯਕੀਨੀ ਬਣਾਉਣ ਲਈ ਕੀ ਕੱਪੜੇ ਸੁੱਖ ਗਏ ਹਨ ਅਤੇ ਨਹੀਂ ਤਾਂ ਮੈਂ ਇੱਦਾਂ ਕਰਦਾ ਹਾਂ ਪਹਿਲਾਂ ਨਾ ਉਹਨਾਂ ਦੀ ਚੈਕ ਕਰਦਾ ਕਿ ਉਹਨਾਂ ਤੋਂ ਕੋਈ ਸਮੈਲ ਤਾਂ ਨਹੀਂ ਬਦਬੂ ਤਾਂ ਨਹੀਂ ਆ ਰਹੀ ਫਿਰ ਮੈਂ ਦੇਖਦਾ ਹਾਂ ਕਿ ਇਹ ਉਹਨਾਂ ਨੂੰ ਹੱਥ ਲਾ ਕੇ ਦੇਖਦਾ ਹਾਂ ਕਿ ਅੱਛੀ ਤਰਾਂ ਸੁੱਕ ਗਏ ਆ ਕਿ ਨਹੀਂ ਸੁਕੇ ਜੇਕਰ ਨਹੀਂ ਸੁਕੇ ਤਾਂ ਉਹਨਾਂ ਨੂੰ ਦੁਬਾਰਾ ਧੁੱਪ ਵਿੱਚ ਪਾਉਂਦਾ ਹਾਂ ਦੁਬਾਰਾ ਧੁੱਪ ਵਿੱਚ ਪਾਉਂਦਾ ਹਾਂ ਜਾਂ ਡਰਾਇਰ ਨਾਲ ਸੁਕਾਉਂਦਾ ਹਾਂ ਮੈਂ ਇਸ ਤਰ੍ਹਾਂ ਇਸ ਕੱਪੜਿਆਂ ਨੂੰ ਯਕੀਨੀ ਬਣਾਉਂਦਾ ਹਾਂ ਕਿ ਇਹ ਕੱਪੜੇ ਸੁੱਕ ਗਏ ਹਨ ਕਿ ਨਹੀਂ ਸੁੱਕੇ